ਸਾਡੇ ਖਿੱਤੇ ਦੇ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਸਾਡੇ ਖਿੱਤੇ ਦੇ ਵਿੱਚ ਜੋ ਕਿ ਕ੍ਰਿਸ਼ਚਨ ਧਰਮ ਹੈ ਉਹ ਘੱਟ ਗਿਣਤੀ ਦੇ ਵਿੱਚ ਮੌਜੂਦ ਹੈ